ਹਾਂਜੀ ਪੰਜਾਬ ਵਿੱਚ ਵੀ ਇੱਕ ਸਿਆਸੀ ਪਾਰਟੀ ਹੈ ਜੋ ਕਿ ਖੇਡਾਂ ਨੂੰ ਬਹੁਤ ਜਿਆਦਾ ਪ੍ਰਮੋਟ ਕਰਦੀ ਆ ਉਹ ਪਾਰਟੀ ਦਾ ਨਾਮ ਅਕਾਲੀ ਦਲ ਇਹ ਹਰੇਕ ਸਾਲ ਇੱਕ ਬਹੁਤ ਹੀ ਤਕੜਾ ਕਬੱਡੀ ਦਾ ਟੂਰਨਾਮੈਂਟ ਕਰਾਉਂਦੀ ਹੈ ਇਸਦੇ ਵਿੱਚ ਬਾਹਰੋਂ ਲੋਕ ਵੀ ਬਾਹਰ ਦੀਆਂ ਟੀਮਾਂ ਵੀ ਖੇਲਣ ਆਉਂਦੀਆਂ ਹਨ